ਪੰਜਾਬੀ ਭਾਸ਼ਾ ਬਾਰੇ ਕੁਝ ਆਮ ਗਲਤ ਧਾਰਨਾਵਾਂ ਇਹ ਨੇਗੇ ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਪੰਜਾਬੀ ਬੋਲਣ ਲੱਗੇ ਸੰਕੋਚ ਕਰਦੀ ਹੈ ਅਤੇ ਆਪਣੇ ਆਪ ਨੂੰ ਪੰਜਾਬੀ ਬੋਲਣ ਲੱਗਿਆ ਨੀਵਾਂ ਮਹਿਸੂਸ ਕਰਦੀ ਹੈ ਵੀ ਜੇ ਅਸੀਂ ਪੰਜਾਬੀ ਬੋਲਾਂਗੇ ਤਾਂ ਸਾਨੂੰ ਜ਼ਿਆਦਾ ਉੱਚੇ ਨਹੀਂ ਸਮਝਿਆ ਜਾਵੇਗਾ ਅਤੇ ਇੰਗਲਿਸ਼ ਬੋਲਣ ਨੂੰ ਜ਼ਿਆਦਾ ਉੱਚਾ ਸਮ ਸਮਝਦੀ ਹੈ ਅੱਜ ਕੱਲ੍ਹ ਦੀ ਜਨਰੇਸ਼ਨ ਅਤੇ ਅੱਜ ਕੱਲ੍ਹ ਦੇ ਸਕੂਲਾਂ ਕਾਲਜਾਂ ਵਿੱਚ ਵੀ ਜ਼ਿਆਦਾਤਰ ਪੰਜਾਬੀ ਬੋਲਣ 'ਤੇ ਰੋਕ ਲੱਗ ਜਾਂਦੀ ਹੈ ਚਾਹੇ ਜੇ ਵੱਡੇ ਅਦਾਰੇ ਲੈ ਲਓ ਚਾਹੇ ਜੇ ਸਕੂਲ ਕਾਲਜ ਲੈ ਲਓ ਉਹਨਾਂ 'ਤੇ ਵੀ ਪੰਜਾਬੀ ਬੋਲਣ 'ਤੇ ਰੋਕ ਲੱਗੀ ਹੋਈ ਹੈ ਜੋ ਕਿ ਬਹੁਤ ਗਲਤ ਹੈ ਇਸ ਲਈ ਸਮਾਜ ਦੇ ਹਿੱਤ ਵਿੱਚ ਪੰਜਾਬੀ ਭਾਸ਼ਾ ਨੂੰ ਸਾਨੂੰ ਕਿਸੇ ਮੁਕਾਮ 'ਤੇ ਪਹੁੰਚਾਉਣ ਲਈ ਸਾਨੂੰ ਪੰਜਾਬੀ ਭਾਸ਼ਾ ਦਾ ਇਸਤੇਮਾਲ ਕਰਨਾ ਪੈਣਾ ਜੇਕਰ ਅਸੀਂ ਪੰਜਾਬੀ ਭਾਸ਼ਾ ਬੋਲਾਂਗੇ ਸਮਝਾਂਗੇ ਤਾਂ ਹੀ ਸਾਨੂੰ ਤਾਂ ਹੀ ਅਸੀਂ ਅੱਗੇ ਜਾ ਸਕਦੇ ਹਾਂ ਜੇਕਰ ਅਸੀਂ ਪੰਜਾਬੀ ਭਾਸ਼ਾ ਵਿੱਚ ਜਿਹਨੂੰ ਕਿਸੇ ਮੁਕਾਮ 'ਤੇ ਪਹੁੰਚਾਉਣਾ ਚਾਹੁੰਦੇ ਹਾਂ ਤਾਂ ਕਿੱਤਾ ਮੁਖੀ ਰੁਜ਼ਗਾਰ ਦੀ ਸਾਨੂੰ ਮੌਕੇ ਪੈਦਾ ਕਰਨੇ ਚਾਹੀਦੇ ਨੇ ਕੋਰਸ ਚਾਹੇ ਜੀ ਉਹ ਇੰਜੀਨੀਅਰ ਕੋਰਸ ਹੈ ਚਾਹੇ ਜੀ ਉਹ ਪੰਜਾਬੀ ਕੋਰਸ ਹੈ ਚਾਹੇ ਜੀ ਇੰਜੀਨੀਅਰ ਕੋਰਸ ਹੈ ਚਾਹੇ ਜੀ ਕੋਈ ਅਧਿਆਪਕ ਟੀਚਰ ਵਾਲਾ ਕੋਰਸ ਹੈ ਉਹ ਸਾਨੂੰ ਪੰਜਾਬੀ ਦੇ ਵਿੱਚ ਹੀ ਕਰਨਾ ਚਾਹੀਦਾ ਸਾਡੇ ਕਿੱਤਾ ਸਾਡੀ ਸਰਕਾਰ ਨੂੰ ਵੀ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਜ਼ਿਆਦਾ ਤੋਂ ਜ਼ਿਆਦਾ